ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਪਿੰਡ ਦੇ ਬੱਸ ਸਟੈਂਡ ਦੇ ਕੋਲ ਬਿੰਦਰ ਦਾ ਇੱਕ ਆਰ ਓ ਲੱਗਿਆ ਹੋਇਆ ਹੈ ਉਸ ਕੋਲ ਹਜ਼ਾਰਾਂ ਕੈਂਪਰ ਹਨ ਉਸ ਉਸਦੇ ਉਹ ਪਾਣੀ ਦੀ ਸਪਲਾਈ ਘਰ ਘਰ ਕਰਦਾ ਹੈ ਤਾਂ ਜੋ ਕਿ ਵਿਆਹਾਂ ਵਿੱਚ ਕਿਸੇ ਨੂੰ ਰੁਕਾਵਟਾਂ ਨਾ ਆਵੇ ਉਸਦਾ ਆਰ ਓ ਬਹੁਤ ਵਧੀਆ ਸਾਫ ਸੁਥਰਾ ਪਾਣੀ ਹੁੰਦਾ ਹੈ ਤਾਂ ਜੋ ਕਿ ਕਿਸੇ ਨੂੰ ਵੀ ਰੁਕਾਵਟ ਨਾ ਆਵੇ ਇਸ ਤੋਂ ਬਿਨਾਂ ਸਾਡੇ ਪਿੰਡ ਵਿੱਚ ਹੋਰ ਕਈ ਥਾਵਾਂ 'ਤੇ ਪਾਣੀ ਦਾ ਪ੍ਰਬੰਧ ਹੁੰਦਾ ਹੈ ਜਿਵੇਂ ਕਿ ਗਊਸ਼ਾਲਾ ਦੇ ਵਿੱਚ ਮੋਟਰ ਲੱਗੀ ਹੋਈ ਹੈ ਉਸ ਉੱਥੋਂ ਵੀ ਪਾਣੀ ਪੀਣ ਨੂੰ ਵਿਆਹਾਂ ਦੇ ਵਿੱਚ ਵਧੀਆ ਮਿਲਦਾ ਹੈ ਵਧੀਆ ਮਿਲਦਾ ਹੈ

ਉਸ ਵੱਲੋਂ ਪਾਣੀ ਵਿੱਚ ਕਈ ਕਈ ਪਾਣੀ ਵਧੀਆ ਥਾਵਾਂ 'ਤੇ ਲਿਆਇਆ ਜਾ ਜਾਂਦਾ ਹੈ ਜਿਵੇਂ ਕਿ ਕਿਸੇ ਦਾ ਭੋਗ ਜਾਂ ਵਿਆਹਾਂ ਵਿਆਹ ਤੋਂ ਬਿਨਾਂ ਹੋਰ ਪ੍ਰੋਗਰਾਮਾਂ ਵਿੱਚ ਉਸਦਾ ਪਾਣੀ ਆਉਂਦਾ ਹੈ ਤਾਂ ਜੋ ਕਿ ਕਿਸੇ ਨੂੰ ਪਰੇਸ਼ਾਨੀ ਨਾ ਆਵੇ ਉਸ ਕੋਲ ਪਾਣੀ ਪੁਜਾਣ ਲਈ ਗੱਡੀ ਦਾ ਪ੍ਰਬੰਧ ਹੈ ਪਾਣੀ ਇਸ ਤੋਂ ਬਿਨਾਂ ਹੋਰ ਵੀ ਕਈ ਥਾਵਾਂ 'ਤੇ ਉਸ ਵੱਲੋਂ ਪਾਣੀ ਦਾ ਪ੍ਰਬੰਧ ਵਧੀਆ ਢੰਗ ਨਾਲ ਕੀਤਾ ਜਾਂਦਾ ਹੈ ਤਾਂ ਜੋ ਕਿ ਕਿਸੇ ਨੂੰ ਪਰੇਸ਼ਾਨੀ ਨਾ ਆਵੇ ਇਸ ਨਾਲ ਉਸ ਵੱਲੋਂ ਵਿਆਹਾਂ ਵਿੱਚ ਸਵੇਰੇ ਅਤੇ ਸ਼ਾਮ ਨੂੰ ਵੀ ਪਾਣੀ ਦਾ ਪ੍ਰਬੰਧ ਕੀਤਾ ਜਾਂਦਾ ਹੈ ਧੰਨਵਾਦ ਜੀ